ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਜੀਤ ਸਿੰਘ ਗੱਲ ਕਰਦਾ ਪਿਆ ਜੀ ਹਾਂਜੀ ਮੈਂ ਤੁਹਾਡੀ ਓਲਾ ਐਪ ਤੋਂ ਕੈਬ ਬੁੱਕ ਕੀਤੀ ਸੀ ਕੱਲ੍ਹ ਹਾਂਜੀ ਅਤੇ ਮੈਂ ਸਰ ਕੱਲ੍ਹ ਨੂੰ ਏ ਏਅਰਪੋਰਟ 'ਤੇ ਜਾਣਾ ਆ ਮੇਰੀ ਛੇ ਵਜੇ ਦੀ ਸਰ ਐਂਟਰੀ ਆ ਅਤੇ ਨੌਂ ਵਜੇ ਦੀ ਮੇਰੀ ਫਲਾਈਟ ਆ ਜਿੱਦਾਂ ਤੁਹਾਨੂੰ ਪਤਾ ਹੀ ਆ ਭਾਅ ਜੀ ਵੀ ਹੁਣ ਧਰਨੇ ਵਗੈਰਾ ਬਹੁਤ ਲੱਗਦੇ ਪਏ ਆ ਟਰੈਫਿਕ ਵੀ ਬਹੁਤ ਜਾਮ ਹੁੰਦਾ ਆ ਅਤੇ ਇਸ ਕਰਕੇ ਮੇਰੀ ਮੀਟ ਅਰਜੈਂਟ ਮੀਟਿੰਗ ਆ ਅਤੇ ਉਹ ਮੇਰੀ ਫਲਾਈਟ ਨਾ ਮਿਸ ਨਹੀਂ ਹੋਣੀ ਚਾਹੀਦੀ ਭਾਅ ਜੀ ਤਾਂ ਤੁਸੀਂ ਮੈਨੂੰ ਪਲੀਜ਼ ਇੰਨਾ ਕੁ ਯਕੀਨ ਦਵਾਓ ਕਿ ਤੁਸੀਂ ਕੱਲ੍ਹ ਜੇ ਤੁਸੀਂ ਅੱਧਾ ਘੰਟਾ ਪਹਿਲਾਂ ਵੀ ਆਉਣਾ ਆ ਤੁਸੀਂ ਆਪਣੇ ਟਾਈਮ ਤੋਂ ਤਾਂ ਤੁਸੀਂ ਉਹ ਵੀ ਆ ਸਕਦੇ ਹੋ ਅਤੇ ਇਹਦੇ ਨਾਲ ਕੀ ਹੋਊਗਾ ਕਿ ਆਪਾਂ ਜੇ ਮਾੜਾ ਮੋਟਾ ਟਰੈਫਿਕ ਵੀ ਮਿਲੂਗਾ ਤਾਂ ਉਹ ਵੀ ਆਪਣਾ ਕਵਰ ਹੋ ਜਾਏਗਾ ਟਾਈਮ ਹਾਂਜੀ ਅਤੇ ਜੇ ਤੁਹਾਨੂੰ ਕੋਈ ਸ਼ੋਰਟਕੱਟ ਪਤਾ ਰਸਤਾ ਏਅਰਪੋਰਟ 'ਤੇ ਜਾਣ ਵਾਸਤੇ ਤਾਂ ਉਹ ਤਾਂ ਵਾਹਲਾ ਹੀ ਬੈਟਰ ਆ ਭਾਅ ਜੀ ਹਾਂਜੀ ਅਤੇ ਤੁਸੀਂ ਮੈਨੂੰ ਪਲੀਜ਼ ਇੰਨਾ ਕੁ ਦੱਸ ਦਿਓ ਕਿੰਨੇ ਵਜੇ ਆਉਂਗੇ ਅਤੇ ਆਪਾਂ ਕਿੰਨੇ ਵਜੇ ਤੁਰਨਾ ਆ ਇਸ ਤੋਂ ਪਹਿਲਾਂ ਕਿ ਆਪਣੀ ਫਲਾਈਟ ਮਿਸ ਹੋ ਜਾਵੇ ਕਿ ਇਹਦੇ ਨਾਲ ਕਿ ਆਪਾਂ ਪਲੈਨ ਬਣਾ ਕੇ ਇੱਕ ਚੱਲਾਂਗੇ ਭਾਅ ਜੀ ਤੋਂ ਵਧੀਆ ਗੱਲ ਆ ਹਾਂਜੀ ਓਕੇ ਬਾਈ ਥੈਂਕ ਯੂ